ਹਾਂਜੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਡਾਂਸ ਕਰਨ ਦਾ ਮੌਕਾ ਮਿਲਿਆ ਹੈ ਛੋਟੇ ਹੁੰਦੇ ਤੋਂ ਲੈ ਕੇ ਹੀ ਮੇਰੀ ਡਾਂਸ ਵਿੱਚ ਕਾਫੀ ਰੁਚੀ ਸੀ ਮੇਰੇ ਅਧਿਆਪਕਾਂ ਨੂੰ ਵੀ ਮੈਨੂੰ ਡਾਂਸ ਸਿਖਾਉਣ ਦੇ ਵਿੱਚ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਸੀ ਮੈਨੂੰ ਖੁਦ ਬ ਖੁਦ ਹੀ ਡਾਂਸ ਦੇ ਸਾਰੇ ਸਟੈਪ ਆਉਂਦੇ ਹੁੰਦੇ ਸੀ ਕਈ ਵਾਰ ਮੇਰੇ ਨਾਲ ਇੱਦਾਂ ਹੋਇਆ ਸਾਡੇ ਸਕੂਲ ਵਿੱਚ ਜਦੋਂ ਕਦੇ ਪ੍ਰੋਗਰਾਮ ਹੁੰਦਾ ਸੀ ਤਾਂ ਅਧਿਆਪਕ ਮੈਨੂੰ ਬਿਨਾਂ ਦੱਸੇ ਹੀ ਮੇਰਾ ਨਾਮ ਦਰਜ ਕਰ ਦਿੰਦੇ ਸਨ ਡਾਂਸ ਦੇ ਵਿੱਚ ਜਦੋਂ ਕਿ ਉਹ ਮੈਨੂੰ ਦੱਸਦੇ ਵੀ ਨਹੀਂ ਸਨ ਤਾਂ ਪ੍ਰੋਗਰਾਮ ਤੋਂ ਐਂਨ ਸਮੇਂ 'ਤੇ ਉਹਨਾਂ ਨੇ ਮੈਨੂੰ ਦੱਸਣਾ ਜਿਸ ਵਿੱਚ ਕਿ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਕਾਲਜ ਦੇ ਦਿਨਾਂ 'ਚ ਵੀ ਮੈਨੂੰ ਬਹੁਤ ਵੱਧ ਚੜ ਕੇ ਹਿੱਸਾ ਲਿਆ ਡਾਂਸ ਦੇ ਵਿੱਚ ਮੈਂ ਬਚਪਨ ਤੋਂ ਹੀ ਕਾਫੀ ਇਨਾਮ ਆਪਣੇ ਨਾਮ ਕਰਵਾਏ ਨੇ ਕਈ ਵਾਰ ਕਾਲਜ ਦੇ ਵਿੱਚ ਵੀ ਇੱਦਾਂ ਹੋ ਜਾਣਾ ਕਿ ਕਾਲਜ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਣਾ ਅਤੇ ਉਹ ਸਾਨੂੰ ਸਿਰਫ਼ ਇੱਕ ਦਿਨ ਪਹਿਲਾਂ ਹੀ ਦੱਸਦੇ ਸਨ ਜਿਸ ਕਰਕੇ ਕਿ ਮੈਨੂੰ ਕਾਲਜ ਦੇ ਵਿੱਚ ਭਾਗ ਲੈਣ ਦੇ ਵਿੱਚ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ